ਜਦੋਂ ਮੈਂ ਛੋਟਾ ਸੀ ਮੇਰਾ ਬਾਪੂ ਮੈਨੂੰ ਸਾਈਕਲ 'ਤੇ ਘੁੰਮਾਉਂਦਾ ਸੀ ਇਹ ਮੇਰੀ ਬਹੁਤ ਪੁਰਾਣੀ ਯਾਦ ਹੈ ਇ ਜਦੋਂ ਇ ਹੁਣ ਇ ਹੁਣ ਵੀ ਮੈਨੂੰ ਇਹ ਬਹੁਤ ਯਾਦ ਆਉਂਦੀ ਹੈ ਕਿ ਮੇਰਾ ਬਾਪੂ ਮੈਨੂੰ ਸਾਈਕਲ 'ਤੇ ਕਿਵੇਂ ਘੁੰਮਾਉਂਦਾ ਸੀ